ਮੈਂ ਪੰਜਾਬੀ ਭਾਸ਼ਾ ਦੀ ਗੱਲ ਕਰਾਂ ਤਾਂ ਦੇਖਿਆ ਏ ਮੈਨੇ ਕਿ ਅੱਜ ਕੱਲ੍ਹ ਵਪਾਰ ਵਿੱਚ ਪੰਜਾਬੀ ਭਾਸ਼ਾ ਭੁੱਲਦੇ ਹੀ ਜਾ ਰਹੇ ਨੇ ਜਦੋਂ ਕਿ ਜਿਹੜਾ ਹੈਗਾ ਇਹ ਆਸਾਨੀ ਨਾਲ ਪੜ੍ਹੀ ਜਾਣ ਵਾਲੀ ਭਾਸ਼ਾ ਹੈ ਬੜੀ ਪਿਆਰੀ ਭਾਸ਼ਾ ਹੈ ਪੰਜਾਬੀ ਜਿਵੇਂ ਕਿ ਵਪਾਰ ਵਾਲਿਆਂ ਦੇ ਵਿੱਚ ਦੇਖਿਆ ਜਾਂਦਾ ਕਿ ਇੰਗਲਿਸ਼ ਵਿੱਚ ਆਪਣੇ ਬੋਰਡ ਲਗਾਏ ਜਾਂਦੇ ਨੇ ਪੰਜਾਬੀ ਨੂੰ ਭੁੱਲਦੇ ਜਾ ਰਹੇ ਨੇ ਪੰਜਾਬੀ ਇੰਨੀ ਅ ਚੰਗੀ ਭਾਸ਼ਾ ਹੈ ਜਿਹਦੇ ਨਾਲ ਆਪਾਂ ਨੂੰ ਦੇਖਣ 'ਚ ਬੋਲਣ 'ਚ ਆਸਾਨੀ ਲੱਗਦੀ ਹੈ ਕਿ ਹਾਂਜੀ ਇਹ ਸਾਡੀ ਆਪਣੀ ਮਾਤਰ ਭਾਸ਼ਾ ਹੈ ਵਪਾਰ ਦੇ ਵਿੱਚ ਜਿਹੜੀ ਏ ਪੰਜਾਬੀ ਭਾਸ਼ਾ ਭੁੱਲਣ ਕਰਕੇ ਸਾਨੂੰ ਜਿਹੜੀ ਹੈਗੀ ਆ ਬੜੇ ਆਉਣ ਵਾਲੇ ਟਾਈਮ 'ਚ ਹੋਰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਆਪਾਂ ਦੇਖਣ 'ਚ ਆਇਆ ਕਿ ਇਹ ਭੁੱਲਦੇ ਜਾ ਰਹੇ ਆ ਬੱਚਿਆਂ ਨੂੰ ਪਤਾ ਨਹੀਂ ਲੱਗਦਾ ਵਪਾਰ ਦੀ ਉਹਦੇ ਵਿੱਚ ਹੋਣ ਕਰਕੇ ਨਾ ਇਹ ਪਿੱਛੇ ਜਾ ਰਿਹਾ ਆਪਣੀ ਪੰਜਾਬੀ ਭਾਸ਼ਾ ਪਿੱਛੇ ਜਾ ਰਹੀ ਹੈ ਮੈਂ ਤਾਂ ਇਹੀ ਕਵਾਂਗੀ ਕਿ ਪੰਜਾਬੀ ਨੂੰ ਬੜਾਵਾ ਦੇਵੋ ਅਤੇ ਆਪਣਾ ਪੰਜਾਬੀ ਦੇ ਵਿੱਚ ਹੀ ਬੋਰਡ ਆਪਣੇ ਲਗਾਉਣੇ ਸ਼ੁਰੂ ਕਰੋ